ਹਾਂਜੀ ਟੈਕਨੋਲਜੀ ਦਾ ਫਾਇਦਾ ਤਾਂ ਦੇਖੋ ਸਾਨੂੰ ਸਾਰਿਆਂ ਨੂੰ ਮਿਲਦਾ ਹੀ ਪਿਆ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਜਿੱਥੇ ਮਸ਼ੀਨਾਂ ਆਪਣਾ ਕੰਮ ਇੰਨਾ ਵਧੀਆ ਤਰੀਕੇ ਨਾਲ ਕਰ ਦਿੰਦੀਆਂ ਨੇ ਐਕੋਰੇਟ ਕਰ ਦਿੰਦੀਆਂ ਨੇ ਸਾਨੂੰ ਟਾਈਮ ਜਿੱਥੇ ਬਹੁਤ ਜ਼ਿਆਦਾ ਲੱਗਦਾ ਸੀ ਤਕਨਾਲੋਜੀ ਇੱਕ ਇੰਨਾ ਵਧੀਆ ਸਾਧਨ ਹੈ ਇਨਸਾਨ ਲਈ ਜਿੱਥੇ ਉਹਨਾਂ ਦਾ ਕੰਮ ਘੰਟਿਆਂ ਵਿੱਚ ਹੁੰਦਾ ਸੀ ਉਹ ਮਿੰਟਾਂ ਤੋਂ ਵੀ ਥੱਲੇ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆ ਗਿਆ ਟੈਕਨੋਲਜੀ ਦਾ ਵਿਸ਼ਾ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਉਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਇਸ ਦੇ ਬਾਰੇ ਜਾਣਨਾ ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਵਧੀਆ ਕਿਉਂਕਿ ਆਉਣ ਵਾਲਾ ਯੁੱਗ ਆਪਾਂ ਨੂੰ ਲੱਗ ਹੀ ਰਿਹਾ ਕਿ ਇਹ ਇੱਕ ਟੈਕਨੋਲੋਜੀ ਦੇ ਉੱਤੇ ਹੀ ਆਪਾਂ ਨਿਰਭਰ ਹੋ ਜਾਵਾਂਗੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਆਪਾਂ ਟੈਕਨੋਲਜੀ ਦੇ ਉੱਤੇ ਨਿਰਭਰ ਕਰ ਰਹੇ ਹਾਂ